ਹਾਂ ਲੋਕਡਾਊਨ ਵਿੱਚ ਮੈਂ ਵੀ ਯੂਟੀਊਬ 'ਤੇ ਵੀਡੀਓਜ ਬਣਾਉਣੀਆਂ ਸ਼ੁਰੂ ਕੀਤੀਆਂ ਸਨ ਅਤੇ ਉਸ ਵਿੱਚ ਮੈਂ ਰੋਜ਼ ਨਵੀਆਂ ਨਵੀਆਂ ਚੀਜ਼ਾਂ ਬਣਾਉਂਦੀ ਸੀ ਅਤੇ ਉਸਦੀਆਂ ਵੀਡੀਓ ਬਣਾਉਂਦੀ ਸੀ ਅਤੇ ਸਾਰੇ ਬੜੇ ਚਾਅ ਦੇ ਨਾਲ ਉਹ ਨਵੀਂਆਂ ਨਵੀਆਂ ਚੀਜ਼ਾਂ ਖਾਂਦੇ ਸੀ ਅਤੇ ਇਸੇ ਬਹਾਨੇ ਵੀਡੀਓਸ ਵੀ ਬਣ ਜਾਂਦੀਆਂ ਸੀ ਅਤੇ ਲੋਕਡਾਊਨ ਨੇ ਇਹ ਲੋਕਾਂ ਨੂੰ ਸ਼ੈਫ ਵੀ ਬਣਾ ਦਿੱਤਾ ਸੀ ਹੋਰ ਕੁਝ ਕਰਨ ਨੂੰ ਹੈਗਾ ਨਹੀਂ ਸੀ ਕੋਈ ਕੁਕਿੰਗ ਦੀ ਵੀਡੀਓਸ਼ ਬਣਾਉਂਦਾ ਸੀ ਅਤੇ ਕੋਈ ਐਜੂਕੇਸ਼ਨ ਦੇ ਨਾਲ ਰਿਲੇਟਿਡ ਵੀਡੀਓ ਬਣਾਉਂਦਾ ਸੀ ਧੰਨਵਾਦ